ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬੇਟਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬੇਟਾ ਹੁੰ ਹੁੰ ਹਾਂਜੀ ਹਾਂਜੀ ਹੁੰ ਹੁੰ ਹਾਂਜੀ ਬੇਟੇ ਭਗਤ ਸਿੰਘ ਜੀ ਨੇ ਪਹਿਲਾਂ ਤਾਂ ਇਹ ਖਟਕੜ ਕਲਾਂ ਇਹਨਾਂ ਦਾ ਬਰਥ ਹੋਇਆ ਸੀਗਾ ਠੀਕ ਹੈ ਇਹਨਾਂ ਦੇ ਜਿਹੜੇ ਜਿੰਨੇ ਰਿਲੇਟਿਵ ਸੀਗੇ ਚਾਚਾ ਜੀ ਪਾਪਾ ਇਹਨਾਂ ਦੇ ਸਾਰੇ ਮਿਲ ਕੇ ਇਹ ਅ ਫਰੀਡਮ ਫਾਈਟਰ ਸੀਗੇ ਅਤੇ ਉਹਨਾਂ ਵਿੱਚੋਂ ਹੀ ਇਹਨਾਂ ਨੂੰ ਅ ਮਤਲਬ ਸੁਣ ਕੇ ਸਾਰਾ ਕੁਛ ਅਤੇ ਇਹ ਵੀ ਇੱਧਰ ਡਿਵੋਟ ਹੋ ਗਏ ਕਿ ਵੀ ਮੈਂ ਵੀ ਦੇਸ਼ ਲਈ ਕੁਛ ਕਰੂੰਗਾ ਅਤੇ ਫਿਰ ਇਹਨਾਂ ਨੇ ਜਦੋਂ ਛੋਟੇ ਸੀਗੇ ਜ਼ਲ੍ਹਿਆਂ ਵਾਲੇ ਬਾਗ ਦਾ ਸਾਕਾ ਹੋਇਆ ਉੱਨੀ ਸੌ ਉੱਨੀ ਵਿੱਚ ਅਤੇ ਉਦੋਂ ਲੋਕ ਸਾਰੇ ਇਕੱਠੇ ਹੋਏ ਸੀਗੇ ਵੀ ਅਸੀਂ ਕੋਈ ਮਤਾ ਕਰੀਏ ਕਿ ਅੰਗਰੇਜ਼ਾਂ ਦੇ ਖਿਲਾਫ਼ ਵੀ ਇਹ ਸਾਨੂੰ ਇੱਦਾਂ ਤੰਗ ਕਰਦੇ ਆ ਅਤੇ ਕਾਫੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਉੱਥੇ ਔਰ ਜਦੋਂ ਉਹ ਜਾ ਰਹੇ ਸੀਗੇ ਅੰਦਰ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਸੀਗਾ ਪਰ ਬਾਹਰ ਨਿਕਲਣ ਨਹੀਂ ਦਿੱਤਾ ਜਾ ਰਿਹਾ ਸੀਗਾ ਸ ਸਿਰਫ ਐਂਟਰੀ ਕਰਵਾ ਰਹੇ ਸੀ ਉਹਨਾਂ ਦੀ ਅਤੇ ਉਹਨਾਂ ਨੇ ਮਤਲਬ ਉਹਨਾਂ ਨੂੰ ਵੀ ਨਹੀਂ ਇਸ ਚੀਜ਼ ਦਾ ਕੋਈ ਨੋਲੇਜ ਹੋਈ ਕਿ ਕੋਈ ਗੜਬੜ ਹੈ ਹੋ ਸਕਦੀ ਜਾਂ ਕੁਛ ਅਤੇ ਜਦੋਂ ਸਾਰੇ ਬਹੁਤ ਜ਼ਿਆਦਾ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਤਾਂ ਉਹਨਾਂ ਨੇ ਕੀ ਕੀਤਾ ਬਿਨਾਂ ਕੁਛ ਕੀਤੇ ਫੌਜ ਆ ਕੇ ਉਹਨਾਂ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਰਨਲ ਡਾਇਰ ਦੇ ਹੁਕਮ ਨਾਲ ਅਤੇ ਕੋਈ ਕਿੱਦਾਂ ਆਪਣੀ ਜਾਨ ਬਚਾਉਣ ਨੂੰ ਕਿੱਧਰ ਭੱਜਿਆ ਕਿੱਧਰ ਭੱਜਿਆ ਹੈ ਨਾ ਕੋਈ ਤਾਂ ਦੀਵਾਰਾਂ 'ਤੇ ਚੜ ਗਏ ਕਾਫੀ ਦੀਵਾਰ ਉੱਚੀਆਂ ਉਹਨਾਂ ਦੀਆਂ ਫਿਰ ਕੋਈ ਖੂਹ ਵਿੱਚ ਕਈਆਂ ਨੇ ਛਲਾਂਗ ਮਾਰ ਦਿੱਤੀ ਕਿ ਅਸੀਂ ਕਿਸੇ ਤਰ੍ਹਾਂ ਆਪਣੇ ਆਪ ਨੂੰ ਅ ਸੇਵ ਕਰੀਏ ਵੀ ਇਹਨਾਂ ਦੇ ਹੱਥ ਨਾ ਆਈਏ ਅਤੇ ਇੱਦਾਂ ਕਰਦੇ ਕਰਦੇ ਸਾਰੇ ਮਤਲਬ ਆਲਮੋਸਟ ਸਾਰਿਆਂ ਨੂੰ ਮਾਰ ਦਿੱਤਾ ਸੀ ਉਹਨੇ ਜਰਨਲ ਡਾਇਰ ਨੇ ਅਤੇ ਇਹ ਫਿਰ ਸਾਕਾ ਜਿਹੜਾ ਸੀਗਾ ਇਹ ਸਾਰਿਆਂ ਨੂੰ ਪਤਾ ਚੱਲਿਆ ਅਤੇ ਉਸ ਤੋਂ ਬਾਅਦ ਜਦੋਂ ਗ ਮਤਲਬ ਭਗਤ ਸਿੰਘ ਉਹ ਵੀ ਸੁਣਦੇ ਸੀ ਵੀ ਇੱਦਾਂ ਹੋਇਆ ਇੱਦਾਂ ਹੋਇਆ ਅਤੇ ਉਹਨਾਂ ਨੇ ਇੱਕ ਆਪਣੇ ਮਨ ਵਿੱਚ ਪ੍ਰਣ ਕੀਤਾ ਕਿ ਵੀ ਮੈਂ ਇਹਦਾ ਬਦਲਾ ਲਊਂਗਾ ਅਤੇ ਜਦੋਂ ਫਿਰ ਹੌਲੀ ਹੌਲੀ ਜਿੱਦਾਂ ਉਹ ਵੱਡੇ ਹੋਏ ਅਤੇ ਉਹਨਾਂ ਨੇ ਸੋਚ ਲਿਆ ਕਿ ਮੈਂ ਨਾ ਅ ਇੰਗਲੈਂਡ ਜਾ ਕੇ ਅਤੇ ਜਨਰਲ ਡਾਇਰ ਨੂੰ ਹੀ ਮਾਰ ਦੇਵਾਂਗਾ ਅਤੇ ਉੱਥੇ ਐਂਟਰੀ ਹੋਣੀ ਬਹੁਤ ਮੁਸ਼ਕਲ ਸੀਗੀ ਅਤੇ ਉਹਨਾਂ ਨੇ ਆਪਣਾ ਭੇਸ ਵੀ ਬਦਲਿਆ ਕਿ ਮੈਂ ਮੈਰਿਡ ਹੈਗਾ ਮੇਰੀ ਵਾਈਫ ਹੈ ਮੇਰੇ ਬੱਚ ਹਾਂਜੀ ਹਾਂਜੀ ਹੈਂ ਅਤੇ ਉਹਨਾਂ ਨੇ ਫਿਰ ਆਪਣਾ ਮਤਲਬ ਐਨ ਜੈਂਟਲਮੈਨ ਲੁੱਕ ਕਰ 'ਤੀ ਕਿ ਮੈਂ ਅੰਗਰੇਜ਼ ਹੈਗਾ ਅਤੇ ਉਹਨਾਂ ਨੇ ਇਸੇ ਗੱਲ 'ਚ ਐਂਟਰੀ ਹੋ ਗਈ ਉਹਨਾਂ ਦੀ ਜਦੋਂ ਉੱਥੇ ਜਾਣ ਲੱਗੇ ਫੈਮਿਲੀ ਵਿੱਚ ਅਤੇ ਉੱਥੇ ਉਹਨਾਂ ਨੇ ਚੈਕਿੰਗ ਤਾਂ ਕਰਨੀ ਸੀ ਇਹਨਾਂ ਨੇ ਚਲਾਕੀ ਨਾਲ ਕੀ ਕੀਤਾ ਬੁੱਕ ਦੇ ਵਿੱਚ ਆਪਣਾ ਗਨ ਜਿਹੜੀ ਸੀ ਉਹ ਛੁਪਾ ਲਈ ਸੀ ਉਹਨੇ ਪੇਜ ਵਿੱਚੋਂ ਕੱਢ ਕੇ ਉਹਦੇ ਵਿੱਚ ਗਨ ਛੁਪਾ ਕੇ ਅੰਦਰ ਚਲੇ ਗਏ ਸੀ ਐਂਟਰੀ ਕਰ ਲਈ ਉੱਥੇ ਜਾਂਦੇ ਹੀ ਇਹਨਾਂ ਨੇ ਜਨਰਲ ਡਾਇਰ ਦੇ ਉੱਤੇ ਗੋਲੀ ਚਲਾ ਦਿੱਤੀ ਜਦੋਂ ਇਹਨਾਂ ਨੇ ਗੋਲੀ ਚਲਾਈ ਹੈ ਅਤੇ ਉਹ ਮਤਲਬ ਨਾਰੇ ਅ ਚ ਨਹਿਰੇ ਨਾਅਰੇ ਲਗਾਏ ਹਾਂਜੀ ਅਤੇ ਜਦੋਂ ਹਾਂਜੀ ਸਾਰੇ ਖੜ੍ਹੇ ਹੋ ਗਏ ਪਰ ਜ ਬਾਕੀ ਕਿਸੇ ਨੂੰ ਕੁਛ ਨਹੀਂ ਕਿਹਾ ਉਹਨਾਂ ਨੇ ਔਰ ਆਪ ਉੱਥੇ ਹੀ ਖੜ੍ਹੇ ਹੋ ਗਏ ਕਿ ਮੈਨੂੰ ਤੁਸੀਂ ਗ੍ਰਿਫ਼ਤਾਰ ਕਰ ਲਓ ਮੈਂ ਹੋਰ ਕਿਸੇ ਨੂੰ ਕੁਛ ਨਹੀਂ ਕਹਿਣਾ ਅਤੇ ਫਿਰ ਉਹਨਾਂ ਨੇ ਆਪਣੀ ਗ੍ਰਿਫ਼ਤਾਰੀ ਖੁਦ ਦਿੱਤੀ ਉਸ ਤੋਂ ਬਾਅਦ ਉਹਨਾਂ ਨੂੰ ਮਤਲਬ ਬਾਅਦ ਵਿੱਚ ਉਹਨਾਂ ਨੂੰ ਕਹਿੰਦੇ ਸ਼ਹੀਦ ਵੀ ਕੀਤਾ ਗਿਆ ਠੀਕ ਹੈ ਫਾਂਸੀ ਵੀ ਜਿਸ ਦਿਨ ਨੂੰ ਉਹਨਾਂ ਨੇ ਕਿਹਾ ਸੀਗਾ ਉਸ ਦਿਨ ਨਹੀਂ ਦਿੱਤੀ ਉਸ ਤੋਂ ਪਹਿਲਾਂ ਦੇ ਦਿੱਤੀ ਉਹਨਾਂ ਪਤਾ ਸੀ ਕਿ ਹਾਂ ਪੰਜਾਬ ਵਿੱਚ ਰੋਲਾ ਰੋਲਾ ਪੈ ਜਾਏਗਾ ਔਰ ਉਹਦੇ ਨਾਲ ਹੀ ਨਾਲ ਦੋ ਉਹਨਾਂ ਦੇ ਹੋਰ ਸਾਥੀ ਸੀਗੇ ਰਾਜਗੁਰੂ ਸੁਖਦੇਵ ਅਤੇ ਉਹਨਾਂ ਨੇ ਵੀ ਮਤਲਬ ਕਿਹਾ ਕਿ ਵੀ ਤੁਸੀਂ ਸਾਨੂੰ ਵੀ ਨਾਲੇ ਹੀ ਹਾਂਜੀ ਤਿੰਨਾਂ ਨੂੰ ਇਕੱਠੇ ਹੀ ਦਿੱਤੀ ਸੀ ਉਹਨਾਂ ਨੇ ਫਾਂਸੀ ਅਤੇ ਫਿਰ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਕਰ 'ਤਾ ਸੀਗਾ ਔਰ ਬਾਹਰ ਸਾਰੇ ਲੋਕ ਖੜ੍ਹੇ ਸੀਗੇ ਔਰ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਕਿ ਵੀ ਇਹਨਾਂ ਨੇ ਇੱਦਾਂ ਕੀਤਾ ਮਤਲਬ ਇੰਨਾ ਦਰਦਨਾਕ ਸੀਨ ਸੀਗਾ ਔਰ ਉਹਨਾਂ ਦੇ ਘਰਦਿਆਂ ਨੂੰ ਵੀ ਬਾਅਦ 'ਚ ਹੀ ਦੱਸਿਆ ਗਿਆ ਵੀ ਇੱਦਾਂ ਹੋ ਗਿਆ ਕਰ 'ਤਾ ਠੀਕ ਹੈ ਨਾ ਆਹ ਚੀਜ਼ ਕੀਤੀ ਸੀਗੀ ਹਾਂ ਅਤੇ ਇੱਦਾਂ ਹੀ ਜਿਹੜੇ ਉਧਮ ਸਿੰਘ ਵੀ ਸੀਗੇ ਉਹ ਵੀ ਜਦੋਂ ਮਤਲਬ ਜ਼ਲ੍ਹਿਆਂਵਾਲਾ ਦਾ ਸਾਕਾ ਹੋਇਆ ਸੀਗਾ ਸਾਰੇ ਲੋਕ ਮਰ ਗਏ ਸੀ ਇਹ ਬਹੁਤ ਛੋਟੇ ਸੀਗੇ ਅਤੇ ਇਹਨਾਂ ਨੇ ਮਤਲਬ ਇਕੱਲੇ ਹੀ ਬ ਬਚੇ ਸੀਗੇ ਉਸ ਟਾਈਮ ਅਤੇ ਉਸ ਚੀਜ਼ ਤੋਂ ਲੈ ਕੇ ਇਹਨਾਂ ਨੇ ਆਪਣੇ ਆਪ ਨੂੰ ਇਹਦੇ ਫਰੀਡਮ ਫਾਈਟਰ ਵਿੱਚ ਹੀ ਕੀਤਾ ਕਿ ਮੈਂ ਵੀ ਦੇਸ਼ ਦੀ ਸੇਵਾ ਹੀ ਕਰੂੰਗਾ ਇੱਦਾਂ ਕਾਫੀ ਸਾਰੇ ਜਿੱਦਾਂ ਲਾਲਾ ਲਾਜਪਤ ਰਾਏ ਉਹਨਾਂ ਨੇ ਵੀ ਲਾਠੀਆਂ ਬਰਦਾਸ਼ਤ ਹਾਂਜੀ ਹਾਂਜੀ ਹਾਂ ਕਿਉਂਕਿ ਏਜਡ ਸੀਗੇ ਨਾ ਹਾਂ ਉਹ ਵੀ ਸੀ ਪਲੱਸ ਉਹਨਾਂ ਦੀ ਏਜ ਵੀ ਸੀਗੀ ਨਾ ਅਤੇ ਉਹਨਾਂ ਨੇ ਆਪਣੀ ਹਾਂ ਏਜ ਦੀ ਵੀ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਕਹਿੰਦੇ ਨਹੀਂ ਮੈਂ ਤਾਂ ਲੜਾਈ ਕਰੂੰਗਾ ਆਪਣੇ ਦੇਸ਼ ਦੀ ਖਾਤਰ ਮਤਲਬ ਬੜੀ ਮੁਸ਼ਕਲਾਂ ਨਾਲ ਅਸੀਂ ਆਜ਼ਾਦੀ ਪਾਈ ਹੈ ਔਰ ਅੰਗਰੇਜ਼ਾਂ ਨੂੰ ਕਿੱਦਾਂ ਕੱਢਿਆ ਇੱਦਾਂ ਬਹੁਤ ਜ਼ਿਆਦਾ ਹਾਂ ਮਹਾਰਾਜਾ ਰਣਜੀਤ ਸਿੰਘ ਨੇ ਹਾਂਜੀ ਹਾਂਜੀ ਕਿੰਨੀਆਂ ਲੜਾਈਆਂ ਕੀਤੀਆਂ ਸਭ ਕੁਛ ਕੀਤਾ ਨਾ ਪੰਜਾਬ ਲਈ ਬਹੁਤ ਕੁਛ ਕੀਤਾ ਉਹਨਾਂ ਨੇ ਓਕੇ ਓਕੇ ਓਕੇ ਬਾਏ